ਹਾਂਜੀ ਅਸੀਂ ਨਾ ਪਿੰਡ ਦੀਆਂ ਜਿਹੜੀਆਂ ਔਰਤਾਂ ਹੈਗੀਆਂ ਜਿਵੇਂ ਘਰਾਂ 'ਚ ਘਰ ਦੇ ਕੰਮ ਕਰਕੇ ਅਸੀਂ ਵੇਹਲੇ ਹੋ ਜਾਂਦੇ ਹੀ ਫਿਰ ਮਤਲਬ ਕਿ ਇਹ ਕੋ ਵੀ ਇਹ ਸਮਾਂ ਕਾਫੀ ਹੋ ਜਾਂਦਾ ਸੀ ਕਿ ਉਸ ਤੋਂ ਬਾਅਦ ਇਹ ਹੁੰਦਾ ਕੀ ਹਾਂ ਹੁਣ ਕੀ ਕਰਨਾ ਹੁਣ ਕੀ ਕਰਨਾ ਤਾਂ ਅਸੀਂ ਸਭ ਨੇ ਸੋਚ ਵਿਚਾਰ ਕੇ ਸਰਪੰਚ ਦਾ ਜਿਹੜਾ ਘਰ ਹੈ ਸਾਡੇ ਲਾਗੇ ਹੀ ਆ ਅਤੇ ਉਹਨਾਂ ਦੇ ਘਰ 'ਚ ਹੀ ਮਤਲਬ ਅਸੀਂ ਸਿਲਾਈ ਮਸ਼ੀਨਾਂ ਰੱਖ ਤੀਆਂ ਬਈ ਚਲੋ ਜਿਹਨੂੰ ਸਿਲਾਈ ਦਾ ਕੰਮ ਆਉਂਦਾ ਵਾ ਕੱਪੜੇ ਸੀ ਸਕਦੀ ਆ ਉਹ ਆਪਣੇ ਹਿਸਾਬ ਨਾਲ ਉਹ ਉੱਥੇ ਕੱਪੜੇ ਸੀ ਜਾਂਦੀਆਂ ਜਿਹਨੂੰ ਚੁ ਮਤਲਬ ਗੋਟੇ ਵਗੈਰਾ ਲਾਉਣੇ ਆਉਂਦੇ ਆ ਕਢਾਈ ਦਾ ਕੰਮ ਆਉਂਦਾ ਉਹ ਉੱਥੇ ਬੈਠ ਕੇ ਮਤਲਬ ਕਢਾਈ ਕੋਈ ਕਢਾਈ ਕਰ ਰਹੀ ਆ ਕੋਈ ਗੋਟਿਆਂ ਦਾ ਕੰਮ ਕਰੀ ਜਾਂਦੀ ਆ ਕਈਆਂ ਨੂੰ ਹੱਥਾਂ ਦੇ ਨਾਲ ਜਿਵੇਂ ਚੁੰਨੀਆਂ ਨੂੰ ਸਿਤਾ ਸਿਤਾਰੇ ਲਾ ਲਾ ਮੋਤੀ ਲਾ ਲਾ ਉਹ ਇਹੋ ਜਿਹੇ ਕੰਮ ਵੀ ਚੱਲੀ ਜਾਂਦਾ ਕੋਈ ਤਰਪਾਈ ਕਰੀ ਜਾ ਰਹੀ ਆ ਅਤੇ ਇਸੇ ਤਰ੍ਹਾਂ ਸਾਡਾ ਮਤਲਬ ਇੱਕ ਵਧੀਆ ਬ ਸਰ ਬਸੇਰਾ ਹੋ ਰਿਹਾ ਕਿ ਸਾਰੇ ਬੈਠ ਕੇ ਇੱਕ ਤਾਂ ਇਹ ਕਿ ਸਾਰਿਆਂ ਲਈ ਇੱਕ ਕਮਾਈ ਦਾ ਸਾਧਨ ਬਣ ਗਿਆ ਕਿ ਆਪਣੇ ਖਰਚੇ ਵਧੀਆ ਚਲਾ ਸਕਣ ਜਿਹਨਾਂ ਦੇ ਘਰ 'ਚ ਤੰਗੀ ਉਹ ਆਪਣੇ ਉਹਨਾਂ ਨਾਲ ਪੈਸਿਆਂ ਨਾਲ ਉਹ ਆਪਣਾ ਕਿਸੇ 'ਤੇ ਨਿਰਭਰ ਨਹੀਂ ਆਪਣੇ ਆਪ 'ਤੇ ਹੋ ਕੇ ਉਹ ਕ ਕੰਮ 'ਚ ਘਰ ਦੇ ਵਧੀਆ ਚਲਾ ਸਕਦੀਆਂ ਵਾਂ ਕਿਸੇ ਵੱਲ ਉਹਨਾਂ ਨੂੰ ਹੱਥ ਵੱਲ ਵੇਖਣਾ ਨਹੀਂ ਪੈਂਦਾ ਆਪਣੇ ਛੋਟੇ ਮੋਟੇ ਖਰਚੇ ਉਹ ਖੁਦ ਚਲਾ ਸਕਦੀਆਂ ਵਾਂ ਅਤੇ ਇੱਕ ਵਧੀਆ ਮਾਹੌਲ ਜਿਹਾ ਬਣ ਗਿਆ ਵਾ ਸਾਡਾ ਕਾਰੋਬਾਰ ਦਾ ਕਾਰੋਬਾਰ ਹੋ ਰਿਹਾ ਇੱਕ ਵਧੀਆ ਸਾਨੂੰ ਮਨੋਰੰਜਨ ਦਾ ਸਾਧਨ ਵੀ ਆ ਕਿ ਉੱਥੇ ਬੈਠ ਕੇ ਚਲੋ ਸਾਰੇ ਹਾਸੀ ਮਜ਼ਾਕ ਵੀ ਕਰੀ ਜਾਂਦੇ ਆ ਕੰਮ ਵੀ ਕਰੀ ਜਾਂਦੇ ਕਿਸੇ ਨੂੰ ਕੰਮ 'ਚ ਨਾ ਥਕਾਨ ਮਹਿਸੂਸ ਹੁੰਦੀ ਆ ਨਾ ਬੋਰੀਅਤ ਲੱਗਦੀ ਆ ਅਤੇ ਸਾਰੇ ਮਿਲ ਜੁਲ ਕੇ ਇੱਕ ਘਰ ਦੇ ਮਾਹੌਲ ਵਾਂਗੂੰ ਅਸੀਂ ਕੰਮ ਕਰ ਰਹੇ ਹਾਂ ਅਤੇ ਸਾਡੇ ਕੰਮ ਨੂੰ ਕਾਫੀ ਸਫਲਤਾ ਵੀ ਮਿਲ ਗਈ ਆ ਕਿਉਂਕਿ ਲੋਕ ਸਾਡੇ ਕੋਲ ਜਿਵੇਂ ਕਾਫੀ ਲੋਕ ਆ ਜਿਹੜੇ ਕਿ ਸੂ ਕੋਈ ਸੂਟ ਸੀ ਸੀਨ ਦੇਣ ਆ ਰਹੀ ਆ ਕੋਈ ਕੋ ਚੁੰਨੀਆਂ ਨੂੰ ਗੋਟੇ ਲਵਾਉਣੇ ਹੁੰਦੇ ਉਹ ਆ ਜਾਂਦੀਆਂ ਇਸੇ ਤਰ੍ਹਾਂ ਸਾਡਾ ਕੰਮ ਇੱਕ ਵਧੀਆ ਚੱਲ ਗਿਆ ਅਤੇ ਸਾਨੂੰ ਖੁਸ਼ੀ ਵੀ ਹੋ ਰਹੀ ਹੈ ਕਿ ਸਾਡਾ ਕੰਮ ਬਹੁਤ ਸਿਰੇ ਚੜ੍ਹ ਗਿਆ